ਭਾਈ ਰਣਧੀਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਜੇਲ ਚਿੱਠੀਆਂ ਨੇ ਬੜੀ ਵੱਡੀ ਚੁਣੌਤੀ ਦਿੱਤੀ ਇਹ ਇੱਕ ਬੜੀ ਵੱਡੀ ਬੌਧਿਕ ਤੌਰ 'ਤੇ ਚੁਣੌਤੀ ਸੀ ਮੇਰੇ ਲਈ ਇੰਨ੍ਹਾਂ ਚੁਣੌਤੀਆਂ ਨੂੰ ਇਹਨਾਂ ਦੀ ਕਿਤਾਬ ਪੜ੍ਹ ਕੇ ਉਹ ਉਹਨਾਂ ਨੇ ਮੇਰਾ ਜੀਵਨ ਬਦਲ ਦਿੱਤਾ ਜਿਨ ਜਿਹੜੀਆਂ ਕਿ ਉਹਨਾਂ ਦੀਆਂ ਚੁਨੌਤੀਆਂ ਮੈਂ ਸਵੀਕਾਰ ਕੀਤੀਆਂ ਉਹ ਆਪਣੇ ਦੋਸਤਾਂ ਨਾਲ ਆਪਣੇ ਪਰਿਵਾਰ ਨਾਲ ਮੈਂ ਸਾਂਝੀਆਂ ਕੀਤੀਆਂ ਉਹਨਾਂ ਨੇ ਮੇਰਾ ਇੰਨਾ ਜੀਵਨ ਬਦਲ ਦਿੱਤਾ ਕਿ ਮੈਂ ਹੁਣ ਸਵੇਰੇ ਉੱਠ ਕੇ ਆਪਣਾ ਨੇਮ ਕਰਦੀ ਹਾਂ ਅਤੇ ਆਪਣਾ ਅੰਮ੍ਰਿਤ ਵੇਲਾ ਸਾਂਭਦੀ ਹਾਂ